ਜਿਵੇਂ ਕਿ ਭਾਰਤ ਵਿੱਚ ਬਹੁਤ ਹੀ ਪ੍ਰਸਿੱਧ ਖੇਡਾਂ ਖੇਡੀਆਂ ਜਾਂਦੀਆਂ ਹਨ ਬਹੁਤ ਹੀ ਤਰ੍ਹਾਂ ਦੀਆਂ ਖੇਡਾਂ ਹਨ ਜਿਹੜੀਆਂ ਕਿ ਭਾਰਤ ਵਿੱਚ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਆਮ ਤੌਰ 'ਤੇ ਕ੍ਰਿਕਟ ਤਾਂ ਹਰ ਕੋਈ ਦੇਖਦਾ ਹੈ ਅਤੇ ਜੋ ਕਿ ਭਾਰਤ ਦੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਖੇਡ ਹੈ ਅਤੇ ਜੋ ਕਿ ਬਹੁਤ ਇੰਟਰਨੈਸ਼ਨਲ ਲੈਵਲ ਤੱਕ ਵੀ ਖੇਡੀ ਜਾਂਦੀ ਹੈ ਅਤੇ ਫਿਲਹਾਲ ਹੀ ਅਜੇ ਇ ਇਸਦਾ ਵਰਲਡ ਕੱਪ ਵੀ ਹੋ ਚੁੱਕਾ ਹੈ ਅਤੇ ਕ੍ਰਿਕਟ ਵਿੱਚ ਕਾਫੀ ਖਿਡਾਰੀਆਂ ਨੇ ਬਹੁਤ ਹੀ ਪ੍ਰਸਿੱਧਤਾ ਹਾਸਲ ਕੀਤੀ ਹੋਈ ਹੈ ਅਤੇ ਕ੍ਰਿਕਟ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੀਆਂ ਪ੍ਰਸਿੱਧ ਖੇਡਾਂ ਹਨ ਜਿਵੇਂ ਕਿ ਫੁੱਟਬਾਲ ਜੋ ਕਿ ਹਰ ਕੋਈ ਜਾਣਦਾ ਆ ਅਤੇ ਹਰ ਕੋਈ ਇਸਨੂੰ ਖੇਡਦਾ ਵੀ ਹੈ ਅਤੇ ਕ੍ਰਿਕਟ ਤੋਂ ਇਲਾਵਾ ਹੋਕੀ ਹੋਕੀ ਵੀ ਬਹੁਤ ਹੀ ਪ੍ਰਸਿੱਧ ਖੇਡ ਹੈ ਹੋਕੀ ਤੋਂ ਇਲਾਵਾ ਦੇਖਿਆ ਜਾਵੇ ਤਾਂ ਬੈਡਮਿੰਟਨ ਕਬੱਡੀ ਕਬੱਡੀ ਵੀ ਜੋ ਕਿ ਬਹੁਤ ਹੀ ਮੰਨਿਆ ਪ੍ਰਮੰਨਿਆ ਖੇਡ ਹੈ ਜੋ ਕਿ ਇੱਥੇ ਪੰਜਾਬ ਦੇ ਪਿੰਡਾਂ ਵਿੱਚ ਵੀ ਅਤੇ ਭਾਰਤ ਵਿੱਚ ਵੀ ਬਹੁਤ ਹੀ ਖੁਸ਼ੀ ਨਾਲ ਖੇਡੀ ਜਾਂਦੀ ਹੈ ਇਸ ਤੋਂ ਇਲਾਵਾ ਆਪਣੇ ਦੇਸ਼ ਵਿੱਚ ਬਹੁਤ ਹੀ ਮਸ਼ਹੂਰ ਅਥਲੀਟ ਹਨ ਕਾਫੀ ਅਥਲੀਟ ਆਪਣੇ ਦੇਸ਼ ਵਿੱਚੋਂ ਹੋ ਚੁੱਕੇ ਹਨ ਜਿਨ੍ਹਾਂ ਦੇ ਜਿਨ੍ਹਾਂ ਵਿੱਚੋਂ ਕੁਛ ਅਜਿਹੇ ਅਥਲੀਟ ਹਨ ਜਿਹੜੇ ਕਿ ਬਹੁਤ ਹੀ ਮਸ਼ਹੂਰ ਹਨ ਜਿਨ੍ਹਾਂ ਨੂੰ ਹਰ ਕੋਈ ਆਮ ਤੌਰ 'ਤੇ ਜਿਨ੍ਹਾਂ ਦੇ ਨਾਮ ਹਰ ਕੋਈ ਜਾਣਦਾ ਹੈ ਇਹਨਾਂ ਵਿੱਚੋਂ ਜਿਵੇਂ ਨੀਰਜ ਚੋਪੜਾ ਹੈ ਜੋ ਕਿ ਓਲੰਪਿਕ ਵਿੱਚ ਅਪ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ ਨੀਰਜ ਚੋਪੜਾ ਬਹੁਤ ਹੀ ਮਸ਼ਹੂਰ ਅਥਲੀਥ ਹੈ ਉਸ ਤੋਂ ਇਲਾਵਾ ਹੇਮਾ ਦਾਸ ਜੋ ਕਿ ਜਿਸਨੂੰ ਗੋਲਡਨ ਗਰਲ ਵੀ ਕਿਹਾ ਜਾਂਦਾ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਅਥਲੀਥ ਹੈ ਜੋ ਅਥਲੀਟ ਦੇ ਪੱਧਰ 'ਤੇ ਬਹੁਤ ਹੀ ਅੱਗੇ ਤੱਕ ਵੱਧ ਚੁੱਕੀ ਆ ਅਤੇ ਉਸਨੂੰ ਗੋਲਡਨ ਗਲਰ ਗਰਲ ਦਾ ਨਾਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸਭ ਤੋਂ ਜੋ ਮੇਨ ਨਾਮ ਹੈ ਮਿਲਖਾ ਸਿੰਘ ਜਿਸਨੂੰ ਹਰ ਕੋਈ ਦੇਸ਼ ਵਿੱਚ ਹਰ ਕੋਈ ਹਰ ਬੱਚਾ ਬੱਚਾ ਮਿਲਖਾ ਸਿੰਘ ਦੇ ਨਾਮ ਨੂੰ ਜਾਣਦਾ ਹੈ ਜੋ ਕਿ ਇੱਕ ਬਹੁਤ ਹੀ ਮਸ਼ਹੂਰ ਅਥਲੀਟ ਸੀ ਅਤੇ ਉਸਦੇ ਉੱਤੇ ਇੱਕ ਫਿਲਮ ਵੀ ਕੱਢੀ ਹੋਈ ਹੈ ਅਤੇ ਜਿਸ ਨੂੰ ਹਰ ਦੇਸ਼ ਦਾ ਹਰ ਕੋਈ ਨਾਗਰਿਕ ਮਿਲਖਾ ਸਿੰਘ ਦੇ ਨਾਮ ਨੂੰ ਜਾਣਦਾ ਹੈ